ਹਾਂਜੀ ਮੈਂ ਬਹੁਤ ਸਾਰੇ ਬੁਣਾਈ ਅਤੇ ਸਿਲਾਈ ਯੂਟੀਊਬ ਚੈਨਲ ਵੇਖਦੀ ਹਾਂ ਮੇਰਾ ਕੋਈ ਸੋਸ਼ਲ ਮੀਡੀਆ ਖਾਤਾ ਤਾਂ ਨਹੀਂ ਹੈ ਪਰ ਮੈਂ ਸਭ ਵੇਖਦੀ ਜ਼ਰੂਰ ਹਾਂ ਜੋ ਵੀ ਮੇਰੇ ਸਾਹਮਣੇ ਵਧੀਆ ਸਵੈਟਰ ਦਾ ਡਿਜਾਇਨ ਆ ਜਾਵੇ ਤਾਂ ਮੈਂ ਉਦੋਂ ਉਸ ਉਦੋਂ ਤੱਕ ਉਸ ਡਿਜ਼ਾਇਨ ਦਾ ਪਿੱਛਾ ਨਹੀਂ ਛੱਡਦੀ ਜਦੋਂ ਤੱਕ ਉਸ ਨੂੰ ਸਿੱਖ ਕੇ ਆਪਣੇ ਕਿਸੇ ਸਵੈਟਰ 'ਤੇ ਪਾ ਨਹੀਂ ਲੈਂਦੀ ਮੈਂ ਆਪਣੇ ਦੋਹਤਰੇ ਦੋਹਤਰੀਆਂ ਦੋਹਤਰੇ ਦੋਹਤਰੀਆਂ ਦੇ ਸਵੈਟਰ ਬਣਾ ਕੇ ਬਹੁਤ ਖੁਸ਼ ਹੁੰਦੀ ਹਾਂ ਫਿਰ ਉਹ ਸਵੈਟਰ ਜਦੋਂ ਉਹ ਪਾ ਕੇ ਦੂਜਿਆਂ ਨੂੰ ਵਿਖਾਉਂਦੇ ਨੇ ਅਤੇ ਕਹਿੰਦੇ ਹਨ ਕਿ ਮੇਰੀ ਨਾਨੀ ਨੇ ਬਣਾਇਆ ਹੈ ਤਾਂ ਸੁਣ ਤਾਂ ਇਹ ਸੁਣ ਕੇ ਬਹੁਤ ਸ਼ਾਂਤੀ ਖੁਸ਼ੀ ਅਤੇ ਸਕੂਨ ਮਿਲਦਾ ਹੈ ਫਿਰ ਮੇਰਾ ਉਹੀ ਡਿਜਾਇਨ ਸਾਰੇ ਮੁਹੱਲੇ ਦੀਆਂ ਔਰਤਾਂ ਵੀ ਆ ਕੇ ਉਤਾਰ ਉਤਾਰ ਕੇ ਲੈ ਜਾਂਦੀਆਂ ਹਨ ਮੈਨੂੰ ਇਹ ਸਭ ਕਰਕੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਨਵੇਂ ਨਵੇਂ ਡਿਜੈਨ ਬਣਾ ਕੇ ਸਭ ਨੂੰ ਪ੍ਰਭਾਵਿਤ ਕਰ ਰਹੀ ਹਾਂ ਅਤੇ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾ ਰਹੀ ਹੁੰਦੀ ਹਾਂ ਇਸ ਤਰਾਂ ਡਿਜੈਨ ਦੀ ਮਸ਼ਹੂਰੀ ਵੀ ਹੋ ਜਾਂਦੀ ਹੈ ਅਤੇ ਕਈ ਵਾਰ ਮੈਂ ਜਿਹੜੇ ਚੈਨਲਾਂ ਤੋਂ ਸਿੱਖਿਆ ਹੁੰਦਾ ਹੈ ਉਹ ਚੈਨਲ ਵੀ ਦੂਜਿਆਂ ਨਾਲ ਸ਼ੇਅਰ ਕਰ ਦਿੰਦੀ ਹਾਂ ਜਿਸ ਨਾਲ ਚੈਨਲ ਵੀ ਮਸ਼ਹੂਰ ਹੋ ਜਾਂਦਾ ਹੈ